ਹਾਂਜੀ ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੋਲ ਕਾਫੀ ਤਰੀ ਤਰ੍ਹਾਂ ਦੇ ਐੱਲ ਸੀ ਡੀ ਹੈ ਐੱਲ ਈ ਡੀ ਨੇ ਅੱਜ ਕੱਲ੍ਹ ਦੇ ਨਿਊ ਜਨਰੇਸ਼ਨਸ ਵਾਲੀ ਵੀ ਐਂਡਰਾਇਡ ਟੀ ਐੱਲ ਈ ਡੀ ਵੀ ਹੈ ਜੋ ਆਪਣੇ ਈਜ਼ੀ ਈਜ਼ੀਲੀ ਕਨੈਕਟ ਹੋ ਜਾਂਦੇ ਫੋਨ ਨਾਲ ਅਤੇ ਸਾਡੇ ਕੋਲ ਹਰ ਸਕਰੀਨ ਉਹਨਾਂ ਦੀ ਵੀ ਬਹੁਤ ਕਾਫੀ ਵਧੀਆ ਹੈ ਅਤੇ ਕਈ ਸੋਲਾਂ ਇੰਚ ਦੇ ਕੋਈ ਬੱਤੀ ਕੋਈ ਬਹੁਤ ਹੀ ਵਧੀਆ ਸਕਰੀਨ ਵਾਲੇ ਨੇ ਅਤੇ ਉਹਨ ਉਹਨਾਂ ਦੇ ਸਾਊਂਡਪਰੂਫ ਵੀ ਬਹੁਤ ਵਧੀਆ ਤੁਹਾਨੂੰ ਤੁਸੀਂ ਦੱਸੋ ਤੁਹਾਨੂੰ ਕਿਸ ਟਾਈਪ ਚਾਹੀਦੇ ਹੈ ਜੀ ਇੱਥੇ ਹਾਂਜੀ ਇੱਥੇ ਹੈਗੇ ਆ ਹਰ ਟੀ ਵੀ ਦੀ ਕੁਆਲਿਟੀ ਦੇ ਬਜਟ ਦੇ ਅਕੋਡਿੰਗ ਹੀ ਹੁੰਦੀ ਆ ਹੁਣ ਸਾਡੇ ਕੋਲ ਸਭ ਤੋਂ ਵਧੀਆ ਵਾਲਾ ਪੰਜਾਹ ਹਜ਼ਾਰ ਤੱਕ ਦੀ ਰੇਂਜ ਵਿੱਚ ਹੋਏਗਾ ਕੰਪਨੀ ਸਾਡੇ ਕੋਲ ਜੀ ਸੈਮਸੰਗ ਹੈ ਐਲ ਜੀ ਹੈ ਔਰ ਐੱਮ ਆਈ ਦਾ ਐਂਡਰਾਇਡ ਵੀ ਨੇ ਜੀ ਕਾਫੀ ਤੁਸੀਂ ਦੱਸੋ ਤੁਹਾਨੂੰ ਕਿਹੜੀ ਵਾਲੀ ਚਾਹੀਦੀ ਹੈ ਜਾਂ ਕਿਸ ਕੰਪਨੀ ਚਾਹੀਦੀ ਆ ਕੀ ਕਹਿੰਦੀ ਹਾਂਜੀ ਇਹ ਤੁਹਾਨੂੰ ਆ ਕੇ ਖੁਦ ਵੀ ਇੱਕ ਵਾਰ ਚੈੱਕ ਕਰਨਾ ਪਏਗਾ ਇਹਨਾਂ ਦੀ ਜੋ ਹੈ ਕੁਐਲਿਟੀ ਵਗੈਰਾ ਇਹ ਸਭ ਕਾ ਤਿੰਨ ਸਾਲ ਤੋਂ ਉੱਪਰ ਤੱਕ ਦੀਆਂ ਵੀ ਹੁੰਦੀਆਂ ਨੇ ਕਾਫੀ ਕਈ ਹੁੰਦੇ ਹੈ ਜਿਹੜੇ ਨਹੀਂ ਵੀ ਹੋ ਪਾਉਂਦੀਆਂ ਇਹ ਤੁਹਾਡੇ ਇੱਕ ਵਾਰ ਖੁਦ ਆ ਕੇ ਚੈੱਕ ਕਰਕੇ ਦੇਖਣ ਦੀ ਵੀ 'ਤੇ ਵੀ ਡਿਪੈਂਡ ਕਰਦਾ ਹਾਂਜੀ ਜਿਹੜੀ ਆਪਣੀ ਬੱਤੀ ਵਾਲੀ ਹੈ ਇਹ ਤੁਹਾਨੂੰ ਮਿਲ ਜਾਏਗੀ ਵੀਹ ਤੀਹ ਜੋ ਉਪਰੋਂ ਉਹਦੀ ਮਿਲ ਉੱਪਰ ਤੱਕ ਦੀ ਮਿਲ ਜਾਏਗੀ ਰੇਂਜ ਵਿੱਚ ਜੇ ਤੁਹਾਨੂੰ ਅੱਜ ਕੱਲ੍ਹ ਦੇ ਚਾਹੀਦੇ ਆ ਐਂਡਰਾਇਡ ਕਨੈਕਟਲੀ ਚਾਹੀਦੇ ਹਨ ਫਿਰ ਪੰਜਾਹ ਸੱਠ ਤੋਂ ਉੱਪਰ ਤੱਕ ਦੇ ਹੀ ਮਿਲ ਸਕਦੇ ਨੇ ਹਾਂਜੀ ਸ਼ੋਪ ਦੀ ਟਾਈਮਿੰਗ ਸਾਡੀ ਸਵੇਰੇ ਦਸ ਵਜੇ ਤੋਂ ਲੈ ਕੇ ਰਾਤ ਦੇ ਦਸ ਵਜੇ ਤੱਕ ਹੁੰਦੀ ਤੁਸੀਂ ਕਦੇ ਵੀ ਆ ਕੇ ਸਾਨੂੰ ਵਿਜ਼ਿਟ ਕਰ ਸਕਦੇ ਹੋ ਹਾਂਜੀ ਥੈਂਕ